ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਠੀਕ ਹੈ ਜੀ ਓਕ ਓਕੇ ਜੀ ਓਕੇ ਹਾਂਜੀ ਹਾਂਜੀ ਹਾਂਜੀ ਜ਼ਰੂਰ ਸਿਆਵਾਂਗੇ ਜੀ ਪਹੁੰਚਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੇ ਕੋਲ ਕੁੜਤੇ ਪਜਾਮੇ ਜੀਨਸ ਹੋ ਗਿਆ ਅਤੇ ਫੋਰਮਲ ਪੈਂਟਾਂ ਹੋ ਗਈਆਂ ਜੀ ਕੋਟ ਪੈਂਟ ਹੋ ਗਏ ਜੇ ਹਰ ਪ੍ਰਕਾਰ ਦੀ ਪੈਂਟ ਸ਼ਰਟ ਹੋ ਗਈ ਜੀ ਹਾਂਜੀ ਆਪਣੇ ਕੋਲ ਸਾਰੇ ਸੂਟ ਸਿਲਾਈ ਹੋ ਜਾਂਦੇ ਆ ਜੀ ਹਾਂ ਹਾਂਜੀ ਹਾਂਜੀ ਸਦਰ ਬਜ਼ਾਰ ਸਮਾ ਸਮਾਟ ਟੇਲਰ ਦੇ ਨਾਂ 'ਤੇ ਦੁਕਾਨ ਆ ਜੀ ਆਪਣੀ ਹਾਂਜੀ ਕੋਈ ਗੱਲ ਨਹੀਂ ਮੈਡਮ ਤੁਸੀਂ ਪਹੁੰਚਿਓ ਸਹੀ ਜ਼ਰੂਰ ਬਹਿ ਕੇ ਆਪਾਂ ਰੇਟ ਦੀ ਗੱਲ ਬਹਿ ਕੇ ਕਰ ਲਵਾਂਗੇ ਹਾਂਜੀ ਆਪਣਾ ਰੇਟ ਦੂਜਿਆਂ ਨਾਲੋਂ ਤਾਂ ਬਹੁਤ ਮੰਨ ਕੇ ਚੱਲੋ ਨੀਚੇ ਆ ਜੀ ਰੇਟ ਆਪਣਾ ਹਾਂਜੀ ਜੀ ਹਾਂਜੀ ਹਾਂਜੀ ਹਾਂਜੀ ਆਪਣੇ ਕੋਲ ਹਾਂਜੀ ਹਾਂਜੀ ਜ਼ਰੂਰ ਮੈਡਮ ਕੱਲ੍ਹ ਨੂੰ ਸੁਬਾਹ ਤੁਸੀਂ ਆ ਸਕਦੇ ਹੋ

ਦੁਕਾਨ ਆਪਣੀ ਹੋ ਜਾਂਦੀ ਹੈ ਜੀ ਸਾਢੇ ਕੁ ਅੱਠ ਵਜੇ ਓਪਨ ਹੋ ਜਾਂਦੀ ਹੈ ਜੀ ਕਿ ਸ਼ਾਮ ਨੂੰ ਫਿਰ ਨੌ ਸਾਢੇ ਨੌ ਵਜੇ ਤੱਕ ਖੁੱਲ੍ਹੀ ਰਹਿੰਦੀ ਜੀ ਹਾਂਜੀ ਜੇ ਤੁਹਾਡਾ ਹਾਂਜੀ ਜੇ ਅੱਜ ਟਾਈਮ ਲੱਗਦਾ ਤਾਂ ਤੁਸੀਂ ਅੱਜ ਵੀ ਆ ਸਕਦੇ ਹੋ ਨਹੀਂ ਕੱਲ੍ਹ ਨੂੰ ਜਦੋਂ ਮਰਜ਼ੀ ਆ ਜਿਓ ਜੀ ਠੀਕ ਹੈ ਮੈਡਮ ਓਕੇ ਜੀ ਓਕੇ ਕੋਈ ਗੱਲ ਨਹੀਂ ਓਕੇ ਮੈਮ ਓਕੇ ਓਕੇ ਥੈਂਕ ਯੂ ਮੈਡਮ ਥੈਂਕ ਯੂ